ਮੈਨੂੰ ਪਾਲਤੂ ਜਾਨਵਰ ਬਹੁਤ ਹੀ ਪਸੰਦ ਹਨ ਕਿਉਂਕਿ ਉਹ ਕਿਉਂਕਿ ਉਹ ਮਨੁੱਖ ਦੇ ਨਾਲੋਂ ਜ਼ਿਆਦਾ ਵਫਾਦਾਰ ਹੁੰਦੇ ਹਨ ਅਤੇ ਉਹ ਘਰ ਦੀ ਰਾਖੀ ਕਰਦੇ ਹਨ ਮੈਨੂੰ ਕੁੱਤਾ ਖਰਗੋਸ਼ ਅਤੇ ਤੋਤਾ ਬਹੁਤ ਹੀ ਪਸੰਦ ਹੈ ਅਤੇ ਇਹਨਾਂ ਵਿੱਚ ਕੁੱਤਿਆਂ ਵਿੱਚ ਵੀ ਕਾਫੀਆਂ ਨਸਲਾਂ ਹਨ ਜੋ ਕਿ ਮੈਨੂੰ ਬਹੁਤ ਹੀ ਸੋਹਣੀਆਂ ਲੱਗਦੀਆਂ ਹਨ ਜਿਵੇਂ ਕਿ ਬੋਕਸਰ ਜਰਮਨ ਸ਼ੈਫਰਡ ਆਦਿ ਅਤੇ ਕੁੱਤੇ ਬਹੁਤ ਹੀ ਵਧੀਆ ਅਤੇ ਸੋਹਣੇ ਹੁੰਦੇ ਹਨ ਜਿਹਦੇ ਕਰਕੇ ਮੈਨੂੰ ਬਹੁਤ ਹੀ ਪਸੰਦ ਹਨ ਅਤੇ ਕੁੱਤਿਆਂ ਨੂੰ ਅਸੀਂ ਘਰ ਦੇ ਵਿੱਚ ਕਿਤੇ ਵੀ ਛ ਖੁੱਲਾਂ ਛੱਡ ਸਕਦੇ ਹਨ ਜਿੱਦਾਂ ਅਸੀਂ ਕਿਤੇ ਬਾਹਰ ਜਾ ਰਹੇ ਹਾਂ ਤਾਂ ਅਸੀਂ ਕੁੱਤਿਆਂ ਨੂੰ ਰਾਖੀ ਲਈ ਛੱਡ ਕੇ ਜਾ ਸਕਦੇ ਹਨ ਕਿਉਂਕਿ ਉਹ ਬਹੁਤ ਹੀ ਵਫ਼ਾਦਾਰੀ ਨਾਲ ਸਾਰੇ ਘਰ ਦੀ ਰਾਖੀ ਕਰਦੇ ਹਨ ਕੁੱਤੇ ਬਹੁਤ ਹੀ ਮਾਸੂਮ ਹੁੰਦੇ ਹਨ ਕਿਉਂਕਿ ਉਹ ਮਨੁੱਖੀ ਭਾਵਨਾਵਾਂ ਤੋਂ ਵ ਵੱਖਰੇ ਹੁੰਦੇ ਹਨ